ਭਾਰਤ ਇੱਕ ਰਾਜਾਂ ਦਾ ਦੇਸ਼ ਹੈ ਮੈਂ ਪੰਜਾਬ ਨੂੰ ਬਿਲੋਂਗ ਕਰਦਾ ਹਾਂ ਅਤੇ ਪੰਜਾਬੀ ਸਾਡੀ ਮਾਂ ਬੋਲੀ ਹੈ ਪੰਜਾਬੀ ਨੂੰ ਅਸੀਂ ਅਹਿਮੀਅਤ ਦਿੰਦੇ ਹੈ ਅੱਜ ਤੋਂ ਪੁਰਾਣੇ ਸਮਿਆਂ ਦੇ ਵਿੱਚ ਰੇਡੀਓ ਦਾ ਮਾਧਿਅਮ ਇੱਕ ਅਜਿਹਾ ਮਾਧਿਅਮ ਸੀ ਜਿਸ 'ਤੇ ਪੰਜਾਬੀ ਦੇ ਵਿੱਚ ਖਬਰਾਂ ਦਿੱਤੀਆਂ ਜਾਂਦੀਆਂ ਸੀ ਜੋ ਕਿ ਖਬਰਾਂ ਦੇਣ ਦਾ ਸਵੇਰੇ ਦੁਪਹਿਰੇ ਅਤੇ ਸ਼ਾਮ ਨੂੰ ਤਿੰਨ ਟਾਈਮ ਖਬਰਾਂ ਦਿੱਤੀਆਂ ਜਾਂਦੀਆਂ ਸੀ ਪਰ ਯੁੱਗ ਬਦਲਦਾ ਗਿਆ ਟੈਲੀਵਿਜ਼ਨ ਆ ਗਏ ਟੈਲੀਵਿਜ਼ਨ 'ਤੇ ਰੂਟੀਨ ਦੀਆਂ ਖਬਰਾਂ ਸ਼ਾਮ ਨੂੰ ਸਾਢੇ ਸੱਤ ਵਜੇ ਜਾਂ ਸਵਾ ਸੱਤ ਵਜੇ ਆਉਂਦੀਆਂ ਸੀ ਜੋ ਕਿ ਜਲੰਧਰ ਦੂਰਦਰਸ਼ਨ 'ਤੇ ਚੈਨਲ 'ਤੇ ਦਿੱਤੀਆਂ ਜਾਂਦੀਆਂ ਸੀ ਉਸ ਤੋਂ ਬਾਅਦ ਹੌਲੀ ਹੌਲੀ ਅਖਬਾਰ ਛਪਣ ਲੱਗ ਗਏ ਜੋ ਕਿ ਜਿਵੇਂ ਆਪਾਂ ਮੰਨ ਲਈਏ ਵੀ ਰੋਜ਼ਾਨਾ ਅਜੀਤ ਜਲੰਧਰ ਜੋ ਕਿ ਜਲੰਧਰ ਤੋਂ ਛੱਪਦਾ ਹੈ ਜੋ ਕਿ ਪੂਰੇ ਪੰਜਾਬ ਨਹੀਂ ਪੂਰੇ ਵਰਲਡ ਦੇ ਵਿੱਚ ਮਸ਼ਹੂਰ ਹੈ ਉਸੇ ਤਰ੍ਹਾਂ ਹੀ ਜਿਵੇਂ ਆਪਾਂ ਜਗਬਾਣੀ ਲਾ ਲਈਏ ਜਗਬਾਣੀ ਵੀ ਛਪਦਾ ਹੈ ਜਗਬਾਣੀ ਅਖਬਾਰ ਦੇ ਨਾਲ ਨਾਲ ਅਤੇ ਅਜੀਤ ਹੋਰ ਵੀ ਪੰਜਾਬੀ ਟ੍ਰਿਬਿਊਨ ਹੋਏ ਦੇਸ਼ ਸੇਵਕ ਹੋਏ ਅਖਬਾਰ ਛਪਦੇ ਹਨ ਉਹਦੇ ਵਿੱਚ ਪੰਜਾਬੀ ਨੂੰ ਅਹਿਮੀਅਤ ਦੇ ਕੇ ਪਹਿਲਾਂ ਪੰਜਾਬੀ ਨੂੰ ਆਪਣੇ ਕੋਲ ਸੋਫਟ ਕਾਪੀ ਆਉਂਦੀਆਂ ਨੇ ਫਿਰ ਆਪਣੇ ਕੋਲ ਇੰਟਰਨੈਟ 'ਤੇ ਆਪਾਂ ਨੂੰ ਪੜ੍ਹਨ ਲਈ ਦਿੱਤ ਵੀ ਆਪਾਂ ਉਹਨਾਂ ਨੂੰ ਪੜ੍ਹ ਸਕਦੇ ਹਾਂ ਜਿਸ ਤਰੀਕੇ ਨਾਲ ਮਰਜ਼ੀ ਜੋ ਕਿ ਆਪਾਂ ਨੂੰ ਅੱਜ ਦੇ ਟਾਈਮ ਦੇ ਵਿੱਚ ਨਿਊਜ਼ ਦੇ ਨਾਲ ਨਾਲ ਰਹਿਣ ਦੇ ਬਹੁਤ ਹੀ ਆਪਣੇ ਮਤਲਬ ਆਪਣੇ ਲਈ ਬਹੁਤ ਹੀ ਵਧੀਆ ਗੱਲ ਹੈ ਮੈਨੂੰ ਲੱਗਦਾ ਹਰ ਇੱਕ ਸਟੇਟ ਵਿੱਚ ਉਸ ਦੀ ਲੋਕ ਭਾਸ਼ਾ ਵਿੱਚ ਨਿਊਜ਼ਪੇਪਰ ਵਗੈਰਾ ਛਪਣਾ ਚਾਹੀਦਾ ਤਾਂ ਜੋ ਨੋਰਮਲ ਬੰਦਾ ਵੀ ਅਪ ਟੂ ਡੇਟ ਰਹੇ